ਪੰਜਾਬੀ ਭਾਸ਼ਾ ਵਿੱਚ ਕੁਝ ਦਿਲਚਸਪ ਅਤੇ ਅਸਧਾਰਨ ਸ਼ਬਦ ਜਿਵੇਂ ਉਹ ਸ਼ਬਦ ਸਮੂਹ ਨੂੰ ਨਾਮ ਵਾਕੰਸ਼ ਕਿਹਾ ਜਾਂਦਾ ਹੈ ਜੋ ਵਾਕ ਵਿੱਚ ਨਾਂਵ ਪੜਨਾਂਵ ਸ਼ਬਦਾਂ ਦੀ ਥਾਂ 'ਤੇ ਕਰਤਾ ਕਰਮ ਜਾਂ ਪੂਰਕ ਵਜੋਂ ਕਾਰਜਸ਼ੀਲ ਹੁੰਦੇ ਹਨ ਨਾਂਵ ਵਾਕੰਸ਼ ਵਾਕ ਦੀ ਬਣਤਰ ਵਿੱਚ ਲਾਜ਼ਮੀ ਹੁੰਦਾ ਹੈ ਪੰਜਾਬੀ ਦੇ ਵਾਕਾਂ ਵਿੱਚ ਪਹਿਲਾਂ ਇਹ ਪਹਿਲੇ ਦੂਜੇ ਤੀਜੇ ਜਾਂ ਚੌਥੇ ਸਥਾਨ ਤੱਕ ਵਿਚਰਦੇ ਹਨ ਇਹਨਾਂ ਵਿੱਚ ਵੀ ਲਾਜ਼ਮੀ ਅਤੇ ਅਖਤਿਆਰੀ ਤੱਥ ਆ ਜਾਂਦੇ ਹਨ ਜਿਸ ਤੋਂ ਕਿਰਿਆ ਦੇ ਕਾਲ ਪਥ ਅਤੇ ਅਵਸਥਾ ਦਾ ਵੱਧ ਹੋਵੇ ਨੂੰ ਕਲਕੀ ਕਿਰਿਆ ਵਾਕੰਸ਼ ਕਿਹਾ ਜਾਂਦਾ ਹੈ ਇਹ ਲਾਚ ਇਹ ਕਰਤਾ ਜਾਂ ਕਰਮ ਨਾਂਵ ਵਾਕੰਸ਼ ਦੇ ਲਿੰਗ ਵਚਨ ਅਤੇ ਪੁਰਖ ਵਿੱਚੋਂ ਇੱਕ ਆਪਣਾ ਰੂਪ ਬਦਲਦਾ ਹੈ ਇਹ ਸੁਤੰਤਰ ਉਪਵਾਕ ਸਿਰਜ ਸਕਦੇ ਹਨ